ਇਸ 'ਤੇ ਵਿਸ਼ਵਾਸ ਕਰੋ ਜਾਂ ਨਾ ਕਰੋ ਦੌੜਨਾ ਇੱਕ ਹਰ ਮੌਸਮ ਦੀ ਗਤੀਵਿਧੀ ਹੋ ਸਕਦੀ ਹੈ ਅਤੇ ਸਿਰਫ ਟ੍ਰੇਡ ਮਿਲ 'ਤੇ ਨਹੀਂ ਬਹੁਤ ਸਾਰੇ ਦੌੜਾਕ ਠੰਢ ਬਾਰਿਸ਼ ਗਰਮੀ ਆਦਿ ਦੇ ਮੌਸਮਾਂ ਵਿੱਚ ਕਸਰਤ ਕਰਨ ਵਿੱਚ ਕੋਈ ਇਤਰਾਜ਼ ਨਹੀਂ ਰੱਖਦੇ ਜਦੋਂ ਤੱਕ ਉਹ ਮੌਸਮ ਲਈ ਤਿਆਰ ਹੁੰਦੇ ਹਨ ਮੈਂ ਪਿਛਲੇ ਸਾਲ ਤੱਕ ਕਦੇ ਵੀ ਆਪਣੇ ਆਪ ਨੂੰ ਇੱਕ ਆਲ ਮੌਸਮ ਦੌੜਾਕ ਨਹੀਂ ਸਮਝਿਆ ਜਦੋਂ ਮੈਨੂੰ ਪਸੰਦ ਦੀ ਲੋੜ ਲਈ ਸਰਦੀਆਂ ਦੇ ਅੰਤ ਵਿੱਚ ਸਿਖਲਾਈ ਦੇਣੀ ਪਈ ਲੰਬੇ ਸਮੇਂ ਤੋਂ ਦੌੜਾਕ ਹੋਣ ਦੇ ਬਾਵਜੂਦ ਇਹ ਪਹਿਲੀ ਵਾਰ ਸੀ ਜਦੋਂ ਮੈਂ ਸੱਚ ਮੁੱਚ ਸਮਝਿਆ ਕਿ ਇੱਥੇ ਖਰਾਬ ਚੱਲ ਰਹੇ ਮੌਸਮ ਵਰਗੀ ਕੋਈ ਚੀਜ਼ ਨਹੀਂ ਹੈ ਸਿਰਫ ਗਲਤ ਪਹਿਰਾਵਾ ਹੈ ਸਿਰਫ ਇੱਕ ਉਪਵਾਦ ਹੈ ਜੇਕਰ ਕੋਈ ਮੌਸਮ ਸਲਾਹਕਾਰ ਚੇਤਾਵਨੀ ਹੈ ਜਿਸ ਨਾਸ ਜਿਸ ਲਈ ਤੁਸੀਂ ਕੱਪੜੇ ਨਹੀਂ ਪਾ ਸਕਦੇ ਭਾਵੇਂ ਤੁਸੀਂ ਗਰਮੀਆਂ ਦੇ ਦਿਨਾਂ ਵਿੱਚੋਂ ਲੰਘ ਰਹੇ ਹੋ ਜਾਂ ਸਰਦੀਆਂ ਦੇ ਦੇ ਤਾਪਮਾਨ ਵਿੱਚੋਂ ਲੰਘ ਰਹੇ ਹੋ ਅਰਾਮ ਮਹੱਤਵਪੂਰਨ ਹੈ

ਤਾਂ ਡਡਲੇ ਇਹ ਵਿਚਾਰ ਕਰਨ ਲਈ ਕਹਿੰਦਾ ਹੈ ਕਿ ਸ਼ੁਰੂਆਤੀ ਲਾਈਨ 'ਤੇ ਪਹੁੰਚਣ ਤੋਂ ਪਹਿਲਾਂ ਸਵੇਰ ਨੂੰ ਇਹ ਠੰਢਾ ਹੋਵੇਗਾ ਮੈਂ ਹਮੇਸ਼ਾ ਅਜਿਹੇ ਕੱਪੜੇ ਲਿਆਉਣ ਦੀ ਸਿਫਾਰਿਸ਼ ਕਰਦਾ ਹਾਂ ਜੋ ਤੁਸੀਂ ਦਾਨ ਕਰ ਸਕਦੇ ਹੋ ਜਾਂ ਸਟਾਰਟ ਲਾਈਨ 'ਤੇ ਸੁੱਟ ਸਕਦੇ ਹੋ ਅਤੇ ਫਿਰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਉਤਾਰ ਸਕਦੇ ਹੋ ਉਹ ਸੁਝਾਅ ਦਿੰਦੀ ਹੈ ਇਸ ਤੋਂ ਇਲਾਵਾ ਉਹ ਦੌੜਾਕਾਂ ਨੂੰ ਦੌੜ ਵਾਲੇ ਦਿਨ ਘੱਟ ਪਹਿਨਣ ਦੀ ਸਲਾਹ ਦਿੰਦੀ ਹੈ ਕਿਉਂਕਿ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਸੀਂ ਗਰਮ ਹੋ ਜਾਓਗੇ ਜੇ ਤੁਸੀਂ ਬਹੁਤ ਗਰਮ ਹੋ ਤਾਂ ਇਹ ਤੁਹਾਡੇ ਪ੍ਰਦਰਸ਼ਨ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਤੁਸੀਂ ਇਸ ਬਾਰੇ ਬਹੁਤ ਜ਼ਿਆਦਾ ਰੁੱਝੇ ਹੋਏ ਹੋਵੋਗੇ ਕਿ ਤੁਸੀਂ ਕਿਵੇਂ ਮਹਿਸੂਸ ਕਰ ਸਕਦੇ ਹੋ ਇਸ ਲਈ ਸਾਨੂੰ ਵੱਖ ਵੱਖ ਮੌਸਮੀ ਸਥਿਤੀਆਂ ਜਿਵੇਂ ਕਿ ਠੰਢ ਗਰਮੀ ਬਾਰਿਸ਼ ਆਦਿ ਮੌਸਮ ਵਿੱਚ ਵੀ ਦੌੜ ਲੈਣਾ ਚਾਹੀਦਾ ਹੈ